ਦੇਖੋ ਜੀ ਪਿੰਡਾਂ ਵਿਚ ਅੱਜ ਕੱਲ੍ਹ ਜਿਵੇਂ ਕਿ ਭਾਈਚਾਰਾ ਹੀ ਚਲਦਾ ਹੈ ਜੀ ਜਿਵੇਂ ਕਿ ਮੰਨ ਲਓ ਅਸੀਂ ਬੀਹੜੀਆਂ ਤੀਹੜੀਆਂ ਕਰਦੇ ਤੇ ਜੀ ਜਿਵੇਂ ਕਿ ਕਣਕ ਵੱਢਣੀ ਹੈ ਅਗਲੇ ਦੇ ਪੰਜ ਕਿੱਲੇ ਹੈ ਅਤੇ ਨਾਲ ਸਾਡੇ ਵੀ ਪੰਜ ਹੈ ਜੀ ਚਾਰ ਬੰਦੇ ਅਸੀਂ ਚਾਰ ਬੰਦੇ ਉਹਨਾਂ ਦੇ ਜੀ ਇੱਕਠੇ ਹੋ ਕੇ ਅਸੀਂ ਪਹਿਲਾਂ ਉਹਨਾਂ ਦੀ ਕਣਕ ਵੱਢਣੀ ਫਿਰ ਆਪਣੀ ਵੱਢਣੀ ਜੀ ਇਸ ਨਾਲ ਕਿਆ ਹੁੰਦਾ ਤਾ ਜੀ ਇੱਕ ਤਾਂ ਸਾਡੇ ਖਰਚੇ ਕੰਟਰੋਲ ਵਿੱਚ ਰਹਿੰਦੇ ਤੇ ਜੀ ਅਤੇ ਨੰਬਰ ਦੋ ਸਾਨੂੰ ਖੇਤਾਂ ਵਿੱਚ ਲੇਬਰ ਦੀ ਲੋੜ ਨਹੀਂ ਤੀ ਪੈਂਦੀ ਅਸੀਂ ਭਾਈਚਾਰੇ ਨਾਲ ਹੀ ਰਲ਼ ਕੇ ਕੰਮ ਕਰਦੇ ਤੇ ਅਤੇ ਉਸ ਨਾਲ ਇੱਕ ਤਾਂ ਐਂਵੇ ਹੁੰਦਾ ਤਾ ਜੀ ਵੀ ਸਾਨੂੰ ਚਾਰ ਪੈਸੇ ਬੱਚਦੇ ਤੇ ਅਤੇ ਨੰਬਰ ਦੋ ਜੀ ਇਸ ਨਾਲ ਜਿਵੇਂ ਕਿ ਸਾਡੇ ਪਿੰਡ ਦੇ ਹੋਰ ਵੀ ਮਜ਼ਦੂਰ ਨੇ ਉਹ ਵੀ ਸਾਡੇ ਨਾਲ ਭਾਈਚਾਰਕ ਸਾਂਝ ਵਿੱਚ ਲੱਗ ਜਾਂਦੇ ਤੇ ਜਿਵੇਂ ਕਿ ਇੱਕ ਦੂਏ ਦਾ ਹੱਥ ਵਟਾਉਣਾ ਕਹਿ ਦਿੰਦੇ ਹਾਂ ਜੀ ਆਪਾਂ ਵੀ ਉਹ ਸਾਡੇ ਨਾਲ ਆਏ ਅਤੇ ਅਸੀਂ ਉਹਨਾਂ ਨਾਲ ਕੰਮ ਕਰਾਤਾ ਉਹਨਾਂ ਨੇ ਸਾਡੇ ਨਾਲ ਕਰਾਤਾ ਇਸ ਨਾਲ ਜੀ ਬਹੁਤ ਹੀ ਬੈਨੀਫਿੱਟ ਤੇ ਜੀ ਸਾਨੂੰ ਵੀ ਅਤੇ ਉਹਨਾਂ ਨੂੰ ਵੀ ਧੰਨਵਾਦ ਜੀ